ਪੌਦਿਆਂ ਦੀਆਂ ਕਿਸਮਾਂ ਅਤੇ ਨਵੀਆਂ ਤਕਨੀਕਾਂ ਜਾਣਨ ਲਈ ਅਸੀਂ ਸਾਡੇ ਪੰਜਾਬ ਦੇ ਵਿੱਚ ਲੁਧਿਆਣੇ ਦੇ ਵਿੱਚ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਜਿਹੜਾ ਹੈਗਾ ਹੈ ਉਹ ਕਿਸਾਨ ਮੇਲਾ ਲੱਗਦਾ ਹੈ ਜਿਹਦੇ ਵਿੱਚ ਹਰੇਕ ਤਰੀਕੇ ਦੀ ਸਾਨੂੰ ਫਸਲ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਵੀ ਅਸੀਂ ਇਸ ਫਸਲ ਤੋਂ ਵੱਧ ਝਾੜ ਲੈ ਸਕਦੇ ਹਾਂ ਅਤੇ ਅਸੀਂ ਉਸ ਦੇ ਬਾਰੇ ਉਹਦੇ ਬੀਜਾਂ ਬਾਰੇ ਉਹਦੇ ਹੋਰ ਜਿਹੜੇ ਪਹਿਲੂਆਂ ਬਾਰੇ ਜਿਹੜੀ ਜਾਣਕਾਰੀ ਹੈਗੀ ਹੈ ਸਾਨੂੰ ਬੜੀ ਵਿਸਥਾਰ ਨਾਲ਼ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਸਾਨੂੰ ਕਈ ਜਗ੍ਹਾ 'ਤੇ ਉਸਦਾ ਬੀ ਵੀ ਜਿਹੜਾ ਹੈਗੈ ਉਹ ਫਰੀ ਉਪਲਬਧ ਕਰਵਾਇਆ ਜਾ ਸਕਦਾ ਕਰਵਾਇਆ ਜਾਂਦਾ ਹੈ ਤਾਂ ਜੋ ਲੋਕ ਉਸ ਨੂੰ ਲੈ ਕੇ ਜਾਣ ਅਤੇ ਉਸਨੂੰ ਉਗਾਉਣ ਅਤੇ ਉਹ ਜਿਹੜਾ ਹੈਗਾ ਉਹ ਪ੍ਰਫੁੱਲ਼ਿਤ ਹੋ ਸਕੇ ਧੰਨਵਾਦ